ਸਟੈਂਪ ਸਿੱਕਿਆਂ ਦਾ ਵਿੱਦਿਅਕ ਮੁੱਲ ਇਹ ਹੈ ਵੀ ਇਸ ਤੋਂ ਵਿਦਿਆਰਥੀਆਂ ਨੂੰ ਉਸ ਸਮੇਂ ਦੇ ਸੱਭਿਅਤਾ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ